ਜੀ ਹਾਂ ਮੈਂ ਕਦੇ ਕਦੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਨੂੰ ਪੋਸਟ ਕਰਦਾ ਹਾਂ ਮੈਂ ਆਮ ਤੌਰ 'ਤੇ ਆਪਣੀਆਂ ਤਸਵੀਰਾਂ ਇੰਸਟਾਗਰਾਮ ਜਾਂ ਫੇਸਬੁੱਕ 'ਤੇ ਹੀ ਪਾਉਂਦਾ ਹਾਂ ਕਿਉਂਕਿ ਮੈਨੂੰ ਇਹ ਐਪ ਵਰਤਣ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਅਤੇ ਮੈਨੂੰ ਇਹ ਐਪ ਚਲਾਉਣੇ ਬਹੁਤ ਹੀ ਸੌਖੇ ਲੱਗਦੇ ਹਨ ਅਤੇ ਇਹ ਮੇਰੇ ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣ ਵਿੱਚ ਬਹੁਤ ਹੀ ਵਧੀਆ ਤਰੀਕਾ ਹੈ ਮੈਂ ਤਸਵੀਰਾਂ ਇਸ ਲਈ ਪੋਸਟ ਕਰਦਾ ਹਾਂ ਕਿਉਂਕਿ ਮੈਨੂੰ ਆਪਣੀਆਂ ਯਾਦਾਂ ਨੂੰ ਸਾਂਝਾ ਕਰਨਾ ਅਤੇ ਦੂਜਿਆਂ ਦੀਆਂ ਜ਼ਿੰਦਗੀਆਂ ਬਾਰੇ ਜਾਣਨਾ ਪਸੰਦ ਹੈ